ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮਾਰਸਲ ਆਰਟ ਸਮੇਂ ਮੇਰੀ ਉਮਰ ਬਚ ਮਤਲਬ ਬਚਪਨ ਤੋਂ ਹੀ ਮੈਂ ਉਸ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣਾ ਸ਼ੁਰੂ ਕਰ ਦਿੱਤੀ ਸੀ ਉਸ ਸਮੇਂ ਮੈਂ ਛੋਟੀ ਜਿਹੀ ਉਮਰ ਵਿੱਚ ਸੀ ਅਤੇ ਮੈਂ ਪੰਜਾ ਮਤਲਬ ਪੰਜਾਬ ਵਿੱਚ ਆ ਕੇ ਮਤਲਬ ਗੱਤਕਾ ਸਿੱਖਿਆ ਜੋ ਕਿ ਇੱਕ ਮਾਰਸਲ ਆਰਟ ਦਾ ਇੱਕ ਭਾਗ ਹੈ ਇਸ ਵਿੱਚ ਮੈਂ ਗੱਤਕਾ ਜੋ ਕਿ ਗੁਰਸਿੱਖ ਪਰਿਵਾਰਾਂ ਭਾਵ ਗੁਰਦੁਆਰਿਆਂ ਵਿੱਚੋਂ ਜਾਂ ਹੋਰ ਪ੍ਰਬੰਧਕ ਕਮੇਟੀਆਂ ਵਿੱਚੋਂ ਗੱਤਕਾ ਸਿਖਾਇਆ ਜਾਂਦਾ ਸੀ ਇਹ ਇੱਕ ਸ ਸਾਡੇ ਸਾਡੇ ਕੀ ਬਹੁਤ ਹੀ ਜ਼ਰੂਰੀ ਹੈ ਗੱਤਕਾ ਸਿੱਖਣਾ ਇੱਕ ਆਮ ਗੱਲ ਨਹੀਂ ਹੈ ਭਾਵ ਕਿ ਹਰੇਕ ਵਿਅਕਤੀ ਦੇ ਕੰਮ ਦੀ ਹੈ ਇਸ ਵਿੱਚ ਆਮ ਤੌਰ 'ਤੇ ਮਾਰਸ਼ਲ ਆਰਟ ਦੀ ਭਾਵਨਾਵਾਂ ਨੂੰ ਜਾਗਰੂਕ ਕੀਤਾ ਗਿਆ ਹੈ ਜੋ ਕਿ ਸਾਡੇ ਹਰੇਕ ਸਮਾਜ ਵਿੱਚ ਹਰੇਕ ਵਿਅਕਤੀ ਨੂੰ ਆਮ ਤੌਰ 'ਤੇ ਦਿੱਤੀ ਜਾਂਦੀ ਇਸ ਦੀ ਉਮਰ ਘੱਟੋ ਘੱਟ ਮਤਲਬ ਆਮ ਤੌਰ 'ਤੇ ਦਸ ਸਾਲ ਦੇ ਬੱਚਿਆਂ ਨੂੰ ਆਮ ਤੌਰ 'ਤੇ ਸਿਖਾਈ ਹੁੰਦੀ ਹੈ ਇਸਦੇ ਦੇ ਕੁਝ ਸੁਰੂਆਤੀ ਦਿਨਾਂ ਵਿਚ ਹੀ ਉਸ ਨੂੰ ਛੋਟੀ ਚੀਜ਼ਾਂ ਤੋਂ ਅਲਰਟ ਕੀਤਾ ਜਾਂਦਾ ਹੈ ਜਿਸ ਵਿੱਚ ਆਮ ਤੌਰ 'ਤੇ ਤਲਵਾਰ ਸਿਆਂ ਮਤਲਬ ਹੋਰ ਕਈ ਚੀਜ਼ਾਂ ਦੀਆਂ ਹਨ ਜਿਹਨਾਂ ਤੋਂ ਉਹਨਾਂ ਨੂੰ ਪ੍ਰੇਰਿਤ ਨਹੀਂ